ਹਾਂਜੀ ਇੱਕ ਬੈਂਕ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਲਈ ਸਾਨੂੰ ਪ੍ਰੋਪਰ ਇੱਕ ਡਿਗਰੀ ਦੀ ਲੋੜ ਹੁੰਦੀ ਹੈ ਜਿਵੇਂ ਬੀਕੌਮ ਵਗੈਰਾ ਅਸੀਂ ਪੂਰੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਬੈਂਕ ਦੇ ਵਿੱਚ ਨੌਕਰੀ ਕਰਨ ਦੇ ਲਈ ਸਾਨੂੰ ਕਈ ਤਰ੍ਹਾਂ ਦੇ ਓਨਲਾਈਨ ਟੈਸਟ ਭਰਨੇ ਪੈਂਦੇ ਆ ਕਈ ਓਨਲਾਈਨ ਟੈਸਟ ਚਲਦੇ ਆ ਜਿਹੜੇ ਸਾਨੂੰ ਕਲੀਅਰ ਕਰਨੇ ਪੈਂਦੇ ਆ ਬੈਂਕ ਦੇ ਵਿੱਚ ਨੌਕਰੀ ਕਰਨ ਦੇ ਲਈ ਸਾਨੂੰ ਕਈ ਤਰ੍ਹਾਂ ਦੀਆਂ ਅਰਜ਼ੀਆਂ ਓਨਲਾਈਨ ਅਪਲਾਈ ਕਰਨੀਆਂ ਪੈਂਦੀਆਂ ਆ ਫਿਰ ਉਸ ਹਿਸਾਬ ਨਾਲ ਸਾਨੂੰ ਨੌਕਰੀ ਜੇ ਮਿਲਦੀ ਆ ਤਾਂ ਉੱਥੇ ਕੰਮ ਕਰਨ ਦੇ ਬਹੁਤ ਜ਼ਿਆਦਾ ਲਾਭ ਹੁੰਦੇ ਆ ਬੈਂਕ ਦੇ ਵਿੱਚ ਜੇ ਤੁਸੀਂ ਨੌਕਰੀ ਕਰਦੇ ਆ ਤਾਂ ਇੱਕ ਤੁਹਾਨੂੰ ਉੱਥੇ ਸਿਟਿੰਗ ਜੋਬ ਮਿਲਦੀ ਆ ਜਿਹਦੇ ਨਾਲ ਮਤਲਬ ਕਿ ਤੁਹਾਡੀ ਵਧੀਆ ਰਹਿੰਦੀ ਆ ਸੈਲਰੀ ਵਧੀਆ ਹੁੰਦੀ ਆ ਇੱਕ ਵਧੀਆ ਪਰਸਨੈਲਿਟੀ ਡਿਵੈਲਪ ਹੁੰਦੀ ਆ ਅਤੇ ਹੋਰ ਬੈਂਕ ਦੇ ਵਿੱਚ ਨੌਕਰੀ ਕਰਨ ਦੇ ਨਾਲ ਸਾਨੂੰ ਕਈ ਤਰ੍ਹਾਂ ਦੀ ਸਾਡਾ ਗਿਆਨ ਵੱਧਦਾ ਆ ਬੈਂਕ ਧੰਨਵਾਦ